ਜਦੋਂ ਵੀ ਮੇਰੇ ਤੋਂ ਸ ਖਾਲੀ ਸਮਾਂ ਹੁੰਦਾ ਹੈ ਅਤੇ ਮੈਂ ਕਿਤੇ ਨਾ ਕਿਤੇ ਜਾਣਾ ਪਸੰਦ ਕਰਦੀ ਹਾਂ ਖਾਸ ਤੌਰ 'ਤੇ ਮੈਂ ਇਤਿਹਾਸਿਕ ਸਥਾਨ ਜਾਂ ਧਾਰਮਿਕ ਅਸਥਾਨ 'ਤੇ ਜਾਣਾ ਪਸੰਦ ਕਰਦੀ ਹਾਂ ਪਰ ਜਦੋਂ ਮੇਰੇ ਕੋਲ ਜ਼ਿਆਦਾ ਛੁੱਟੀਆਂ ਜਾਂ ਜ਼ਿਆਦਾ ਸਮਾਂ ਹੁੰਦਾ ਹੈ ਤਾਂ ਮੈਂ ਰਿਸ਼ਤੇਦਾਰਾਂ ਦੇ ਘਰ ਰਹਿਣਾ ਪਸੰਦ ਕਰਦੀ ਹਾਂ ਪਹਿਲਾਂ ਗੱਲ ਕੀਤੀ ਜਾਵੇ ਇਤਿਹਾਸਿਕ ਸਥਾਨ ਜਾਂ ਧਾਰਮਿਕ ਅਸਥਾਨ ਦੀ ਮੈਂ ਧਾਰਮਿਕ ਸਥਾਨ 'ਤੇ ਜਾਣਾ ਪਸੰਦ ਕਰਦੀ ਹਾਂ ਜਿਵੇਂ ਕਿ ਹਰਿਮੰਦਰ ਸਾਹਿਬ ਜੋ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਾਪਿਤ ਹੈ ਉੱਥੇ ਮੈਂ ਜਾਣਾ ਬਹੁਤ ਪਸੰਦ ਕਰਦੀ ਹਾਂ ਉੱਥੇ ਜਾ ਕੇ ਬਹੁਤ ਹੀ ਜਿਹੜਾ ਏ ਕਿ ਸਕੂਨ ਮਿਲਦਾ ਹੈ ਉੱਥੇ ਮੈਂ ਜਾ ਕੇ ਗੁਰੂ ਦੇ ਦਰਸ਼ਨ ਕਰਦੀ ਹਾਂ ਅਤੇ ਉਹ ਜਿਹੜਾ ਇੱਕ ਧਾਰਮਿਕ ਅਸਥਾਨ ਆ ਇੱਕ ਉੱਥੇ ਬਹੁਤ ਹੀ ਸੰਗਤ ਆਉਂਦੀ ਹੈ ਅਤੇ ਜਿਹੜੇ ਸੰਗਤ ਦੇ ਦਰਸ਼ਨ ਵੀ ਹੁੰਦੇ ਹਨ ਜੇ ਗੱਲ ਕੀਤੀ ਜਾਵੇ ਰਿਸ਼ਤੇਦਾਰਾਂ ਤੋਂ ਜਾਣ ਦੀ ਜੇ ਮੈਂ ਰਿਸ਼ਤੇਦਾਰਾਂ ਤੋਂ ਜਾਵਾਂ ਤਾਂ ਮੈਂ ਉਹਨਾਂ ਕੋਲ ਜ਼ਿਆਦਾ ਟਾਈਮ ਨਹੀਂ ਰਹਿੰਦੀ ਕਿਉਂਕਿ ਮੇਰਾ ਜਿਹੜਾ ਸਕੂਨ ਆ ਕਈ ਘਰਾਂ ਵਿੱਚ ਆਪਾਂ ਨੂੰ ਨਹੀਂ ਮਿਲਦਾ ਤਾਂ ਉਹਨਾਂ ਤੋਂ ਆਪਾਂ ਇੰਨਾਂ ਰਹਿਣਾ ਨਹੀਂ ਪਸੰਦ ਕਰਦੇ ਮੈਂ ਜ਼ਿਆਦਾਤਰ ਰਿਸ਼ਤੇਦਾਰਾਂ ਤੋਂ ਘੱਟ ਹੀ ਰਹਿਣਾ ਪਸੰਦ ਕਰਦੀ ਹਾਂ ਪਰ ਇੱਕ ਦੋ ਦਿਨ ਜੇ ਮੈਂ ਕਿਸੇ ਰਿਸ਼ਤੇਦਾਰ ਤੋਂ ਰਵਾਂ ਤਾਂ ਰਹਿ ਵੀ ਲੈਂਦੀ ਹਾਂ